ਹਿੰਦੁਸਤਾਨ ਵਿੱਚ ਲੋਕਾਂ ਨੂੰ ਸੇਵਿੰਗ ਕਰਨ ਦਾ ਕਾਫ਼ੀ ਸ਼ੌਂਕ ਹੈ ਅਸੀਂ ਹਰ ਕਈ ਤਰੀਕਿਆਂ ਨਾਲ ਸੇਵਿੰਗ ਕਰ ਸਕਦੇ ਹਾਂ ਜੇ ਅਸੀਂ ਪ੍ਰੋਪਰਟੀ ਦੇ ਵਿੱਚ ਰੀਅਲ ਸਟੇਟ ਵਿੱਚ ਵੀ ਪੈਸਾ ਲਗਾ ਕੇ ਉਸ ਦਾ ਬੈਨੀਫਿਟ ਲੈ ਸਕਦੇ ਹਾਂ ਜੇ ਨਹੀਂ ਹੋਰ ਵੀ ਵੱਖ ਵੱਖ ਤਰੀਕੇ ਹੁੰਦੇ ਹਨ ਜਿਸ ਤਰ੍ਹਾਂ ਗੋਲਡ ਗੋਲਡ ਦੇ ਕੋਇਨ ਵੀ ਲੈ ਕੇ ਰੱਖ ਲਈ ਰੱਖ ਸਕਦੇ ਹਾਂ ਜਿਸ ਤਰ੍ਹਾਂ ਸਾਨੂੰ ਉਸ ਪ੍ਰੋਫਿਟ ਕਾਫੀ ਤਰੀਕੇ ਅੱਛਾ ਮਿਲਦਾ ਹੈ ਲਾਈਫ ਇੰਸ਼ੋਰੈਂਸ਼ ਵਿੱਚ ਵੀ ਸੇਵਿੰਗ ਦੀਆਂ ਕਾਫੀ ਅੱਛੀਆਂ ਅੱਛੀਆਂ ਸਕੀਮਾਂ ਆਉਂਦੀਆਂ ਆਉਂਦੀਆਂ ਹਨ ਅਤੇ ਦੇ ਫਿਕਸ ਡਿਪੋਜਿਟ ਨਾਲ ਮੰਥਲੀ ਇੰਟਰਸਟ ਵੀ ਆਉਂਦਾ ਹੈ ਕਾਫੀ ਸਕੀਮਾਂ ਹੁੰਦੀਆਂ ਹਨ ਜਿਸ ਤਰ੍ਹਾਂ ਪੋਸਟ ਆਫਿਸ ਵਿੱਚ ਐਫ ਰੈਕਰਿੰਗ ਤਰ੍ਹਾਂ ਆਪਾਂ ਮੰਥਲੀ ਡਿਪੋਜਿਟ ਕਰਵਾ ਕੇ ਉਸ ਦਾ ਪ੍ਰੋਫਿਟ ਲੈ ਸਕਦੇ ਹਾਂ ਉਸ ਦੀ ਐਫ ਡੀ ਐਫ ਡੀ ਵਿੱਚ ਵੀ ਕਾਫੀ ਇੰਟਰੈਸਟ ਹੁੰਦਾ ਹੈ ਅਤੇ ਉਹ ਫਿਕਸ ਡਿਪੋਜਿਟ ਵਿੱਚ ਵੀ ਕਾਫੀ ਸਾਢੇ ਚਾਰ ਪੰਜ ਸਾਲਾਂ ਵਿੱਚ ਅੱਛੀ ਰਿਟਰਨ ਮਿਲਦੀ ਹੈ ਅਤੇ ਨੌਂ ਦਸ ਸਾਲਾਂ ਵਿੱਚ ਪੈਸਾ ਡਬਲ ਹੋਣ ਦੀ ਵੀ ਹੈ ਹੋ ਸਕਦਾ ਹੈ ਪੋਸਟ ਆਫਿਸ ਵਿੱਚ ਇਸ ਤਰ੍ਹਾਂ ਲਾਈਫ ਇਨਸ਼ੋਰੈਂਸ ਦੇ ਵਿੱਚ ਵੀ ਕਾਫੀ ਅੱਛੇ ਅੱਛੀ ਤਰ੍ਹਾਂ ਦੇ ਪਲੈਨ ਆਉਂਦੇ ਹਨ ਜਿਸ ਤਰ੍ਹਾਂ ਅਸੀਂ ਇਨਵੈਸਟਮੈਂਟ ਕਰਕੇ ਆਪਣੇ ਪੈਸੇ ਨੂੰ ਵਧਾ ਸਕਦੇ ਹਾਂ ਇਸ ਤਰ੍ਹਾਂ ਕਾਫੀ ਤਰੀਕੇ ਦੀਆਂ ਸੇਵਿੰਗ ਸਕੀਮਾਂ ਆਉਂਦੀਆਂ ਹਨ ਜਿਸ ਵਿੱਚ ਸਾਨੂੰ ਅੱਛਾ ਪ੍ਰੋਫਿਟ ਮਿਲਦਾ ਹੈ ਅਤੇ ਹੋਰ ਵੀ ਕਾਫੀ ਅਸੀਂ ਕਿਸੇ ਨੂੰ ਪੈਸੇ ਇੰਟਰਸਟ 'ਤੇ ਦੇ ਕੇ ਵੀ ਆਪਣਾ ਪੈਸਾ ਕਮਾ ਸਕਦੇ ਹਾਂ ਇਸ ਤਰ੍ਹਾਂ ਦੇ ਕਾਫੀ ਹੋਰ ਰਸਤੇ ਹਨ ਜਿਸ ਤਰ੍ਹਾਂ ਅਸੀਂ ਸਾਨੂੰ ਪ੍ਰੋਫਿਟ ਅੱਛਾ ਮਿਲਦਾ ਹੈ